ਹੈਲੋ ਹਾਂਜੀ ਹਾਂਜੀ ਹਾਂਜੀ ਦੱਸੋ ਜੀ ਹਾਂਜੀ ਠੀਕ ਹੈ ਜੀ ਚਾਰਜਸ ਤਾਂ ਲਾ ਲਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਤੁਸੀਂ ਅੱਗੇ ਵੀ ਆਉਂਦੇ ਰਹਿੰਦੇ ਸਾਡੇ ਕੋਲ ਚਾਰਜਿਸ ਦਾ ਤਾਂ ਕੋਈ ਗੱਲ ਨਹੀਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਾਕਿਸਤਾਨੀ ਪਾਕਿਸਤਾਨੀ ਸੂਟ ਹਾਂਜੀ ਹਾਂਜੀ ਹੈਗੇ ਆ ਆਪਣੇ ਕੋਲ ਹੈਗੇ ਐਂ ਤਾਂ ਮੁੰਡੇ ਆਪਣੇ ਕੋਲ ਕਰਨ ਵਾਲੇ ਕਾਰੀਗਰ ਆ ਬਹੁਤ ਤਕੜੇ ਆ ਜੀ ਕੰਮ ਦੀ ਤਾਂ ਕੋਈ ਚੱਕਰ ਨੀ ਹੈਗਾ ਜੀ ਪਰ ਤੁਸੀਂ ਉਹ ਦੱਸੋ ਨਾ ਵੀ ਸਾਨੂੰ ਹੁਣ ਡਿਜਾਇਨ ਵਗੈਰਾ ਜਾਂ ਕੋਈ ਗੋਟਾ ਗਾਟਾ ਹੀ ਲਾਉਣਾ ਜਾਂ ਕੋਈ ਹੋਰ ਚੀਜ਼ ਲਾਉਣੀ ਜਾਂ ਕਿਵੇਂ ਲੈਸ ਲੂਸ ਕਿਓਂਕਿ ਉਹ ਤੁਸੀਂ ਦੱਸ ਸਕਦੇ ਓ ਨਾ ਜੀ ਅਸੀਂ ਤਾਂ ਲਾ ਦੇਣੀ ਹਾਂਜੀ ਨਹੀਂ ਉਹ ਤਾਂ ਚਲੋ ਠੀਕ ਕਰਦੇ ਹਾਂ ਸਾਡੇ ਕੋਲ ਵੀ ਅਵੇਲੇਵਲ ਹੁੰਦੀ ਸਾਰੀ ਚੀਜ਼ ਹੁੰਦੀ ਆ ਤੁਹਾਨੂੰ ਲੋੜ ਪਈ ਤਾਂ ਸਾਡੇ ਕੋਲ ਮਿਲ ਜੂਗੀ ਤਾਂ ਤੁਸੀਂ ਆਪਣੇ ਆਪ ਖੁਦ ਆਪਣੇ ਕੋਲੋਂ ਹੀ ਲੈ ਕੇ ਆਉਗੇ ਹੈਂ ਠੀਕ ਹੈ ਜੀ ਅੱਛਾ ਜੀ

ਨਹੀਂ ਆਉਂਦੀ ਗੀ ਬੰਦੇ ਹੈਗੇ ਬਹੁਤ ਸਾਰੇ ਕਾਰੀਗਰ ਆਪਣੇ ਮੁੰਡੇ ਸਿਆਣੇ ਆ ਜੀ ਵਧੀਆ ਇਹੋ ਜਿਹੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਆ ਕੇ ਉਹਨਾਂ ਨੂੰ ਦਿਓ ਮੌਕਾ ਕਰ ਦੇਵਾਂਗੇ ਤੁਹਾਨੂੰ ਵਧੀਆ ਸਹੀ ਸਮਾਨ ਜਿਹੜਾ ਕਹੋਗੇ ਸੂਟ ਉਸ ਤਰ੍ਹਾਂ ਤਿਆਰ ਕਰ ਦੇਵਾਂਗੇ ਮੈਂ ਉਹ ਹੀ ਨੰਬਰ ਲਾ ਦਾ ਮੈਡਮ ਬੋਲਦੇ ਆ ਮਨਪ੍ਰੀਤ ਮੈਡਮ ਹੀ ਬੋਲਦੇ ਨਾ ਤੁਸੀਂ ਤੁਹਾਡਾ ਨੰਬਰ ਹੈਗਾ ਤੁਹਾਨੂੰ ਕਿੰਨਾ ਸੂਟ ਸਿਓਂ ਕੇ ਦਿੱਤੇ ਤੁਸੀਂ ਦੱਸੋ ਕਦੋਂ ਉਲਾਂਭਾ ਆਇਆ ਜੀ ਉਹ ਤਾਂ ਹੀ ਤੁਹਾਨੂੰ ਕਿਹਾ ਤੁਸੀਂ ਜਿਹੜੀ ਕੁਆਲਟੀ ਜਿਹੜੀ ਚੀਜ਼ ਚਾਹੋਗੇ ਉਹ ਹੀ ਤੁਹਾਨੂੰ ਅਸੀਂ ਤਿਆਰ ਕਰਕੇ ਦੇਵਾਂਗੇ ਜੀ ਹਾਂਜੀ ਉਹ ਤਾਂ ਹੈ ਬਾਕੀ ਤੁਸੀਂ ਦਸਦੋ ਨਾ ਜਿਹੜੀ ਚੀਜ਼ 'ਚ ਕਿਵੇ ਜਾਂ ਕਿਸ ਤਰ੍ਹਾਂ ਬਣਾਉਣਾ ਚਾਹੁਣੇ ਖੁੱਲਾ ਜਿਵੇਂ ਮਰਜੀ ਦਸੋ ਵੀ ਜਿਵੇਂ ਤੁਹਾਡੀ ਚੋਇਸ ਉਸ ਹਿਸਾਬ ਨਾਲ ਹਾਂਜੀ ਆਪਣਾ ਨੈਰੋ ਹਾਂਜੀ ਹਾਂਜੀ ਅੱਛਾ ਅੱਛਾ ਜੀ ਕਿੰਨੇ ਸੂਟ ਤਿਆਰ ਕਰਨੇ ਜੀ ਕਿੰਨੇ ਕਰਵਾਉਣੇ ਆ ਜੀ ਸੂਟ ਤਿਆਰ

ਗੱਲ ਕਰਦੇ ਕੋਈ ਗੱਲ ਨਹੀਂ ਜਦੋਂ ਆਇਓ ਨਾ ਉਦੋਂ ਗੱਲ ਕਰ ਲਿਓ ਠੀਕ ਹੈ ਜੀ ਕੋਈ ਗੱਲ ਨਹੀਂ ਓਕੇ ਜੀ